ਸਤਿ ਸ਼੍ਰੀ ਅਕਾਲ ਜੀ ਮੈਂ ਥੋੜ੍ਹੀ ਦੇਰ ਪਹਿਲਾਂ ਨਾ ਕੈਬ ਬੁੱਕ ਕੀਤੀ ਸੀਗੀ ਅਤੇ ਕੈਬ ਦਾ ਟਾਈਮ ਸੀਗਾ ਦਸ ਵਜੇ ਦਾ ਉੱਥੇ ਸ਼ੋਅ ਹੋ ਰਿਹਾ ਕਿ ਦਸ ਵਜੇ ਪਹੁੰਚਜੂਂਗੀ ਬਟ ਅੱਧਾ ਘੰਟਾ ਹੋ ਗਿਆ ਕੋਈ ਕੈਬ ਨਹੀਂ ਆਈ ਹੈਗੀ ਅਸੀਂ ਉਹਨੂੰ ਡਰਾਈਵਰ ਨੂੰ ਵਾਰ ਵਾਰ ਕੋਲ ਕਰ ਰਹੇ ਹਾਂ ਉਹ ਇਹ ਹੀ ਕਹਿੰਦਾ ਵੀ ਦਸ ਮਿੰਟ 'ਚ ਆ ਰਿਹਾ ਦਸ ਮਿੰਟ 'ਚ ਆ ਰਿਹਾ ਦਸ ਮਿੰਟ ਕਰਦੇ ਕਰਦੇ ਨੂੰ ਉਹਨੇ ਅੱਧਾ ਘੰਟਾ ਸਾਡਾ ਵੇਸਟ ਕਰਤਾ ਅਤੇ ਸਾਨੂੰ ਬਹੁਤ ਜ਼ਰੂਰੀ ਕੰਮ ਸੀਗਾ ਅਸੀਂ ਆਪਣੇ ਪਿੰਡ ਤੋਂ ਪੀ ਜੀ ਆਈ ਜਾਣਾ ਸੀਗਾ ਉੱਥੇ ਸਾਡੇ ਕੋਈ ਐਡਮਿੱਟ ਹੈ ਉਹਨਾਂ ਵਾਸਤੇ ਖਾਣਾ ਲੈ ਕੇ ਜਾਣਾ ਸੀਗਾ ਅਤੇ ਉਹਨੇ ਸਾਰਾ ਟਾਈਮ ਇੱਦਾਂ ਹੀ ਵੇਸਟ ਕਰਤਾ ਅਤੇ ਅਸੀਂ ਤੁਹਾਨੂੰ ਰੀਕੁਐਸਟ ਕਰਦੇ ਹਾਂ ਕਿ ਤੁਸੀਂ ਕੈਬ ਡਰਾਈਵਰ ਤੋਂ ਪਤਾ ਕਰਕੇ ਦੱਸੋ ਕਿ ਉਹ ਕਦੋਂ ਤੱਕ ਆਏਗਾ ਅਤੇ ਕਿੰਨਾਂ ਟਾਈਮ ਉਹਨੂੰ ਲੱਗਣਾ ਹੈ ਆਉਣ 'ਚ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ